ਸਤਿ ਸ਼੍ਰੀ ਅਕਾਲ ਜੀ ਮੈਂ ਨਿਕਿਤਾ ਗੱਲ ਕਰ ਰਹੀ ਹਾਂ ਫੇਸਬੁੱਕ ਦੇ ਇੱਕ ਪੇਜ ਤੋਂ ਦੇਖ ਕੇ ਤੁਹਾਡੇ ਪੇਜ ਤੋਂ ਗਰੋਸਰੀ ਦਾ ਇੱਕ ਸੈੱਟ ਔਡਰ ਕੀਤਾ ਸੀ ਜੋ ਕਿ ਮੈਨੂੰ ਡਿਲੀਵਰੀ ਡੇਟ ਤੋਂ ਪਹਿਲਾਂ ਹੀ ਰਿਸੀਵ ਹੋ ਗਿਆ ਸੀ ਅਤੇ ਜਿਸਦੀ ਪੈਕਿੰਗ ਬਹੁਤ ਸੋਹਣੀ ਅਤੇ ਬਹੁਤ ਸਟਰੋਂਗ ਸੀ ਅਤੇ ਉਸਦਾ ਕਲਰ ਵੀ ਸ ਸੇਮ ਹੀ ਮਿਲਿਆ ਹੈ ਮੈਨੂੰ ਅਤੇ ਪੇਂਟਿੰਗ ਔਰ ਡਿਜ਼ਾਇਨ ਬਹੁਤ ਜ਼ਿਆਦਾ ਸੋਹਣੇ ਹਨ ਅਤੇ ਇਹ ਬੱਤੀ ਦਾ ਇੱਕ ਸੈੱਟ ਸੀ ਅਤੇ ਮੈਨੂੰ ਬੱਤੀ ਦੇ ਬੱਤੀ ਹੀ ਰੀਸੀਵ ਹੋਏ ਹਨ ਇਸ ਦੇ ਗਲਾਸ ਦਾ ਗਲਾਸ ਡਿਜ਼ਾਇਨ ਬਹੁਤ ਸੋਹਣਾ ਹੈ ਅਤੇ ਬਾਊਲਸ ਦੀ ਕੁਆਂਟਿਟੀ ਬਹੁਤ ਵਧੀਆ ਹੈ ਮੈਂ ਇਸ ਬਾਰੇ ਆਪਣੇ ਫਰੈਂਡਸ ਨੂੰ ਜ਼ਰੂਰ ਦੱਸਾਂਗੀ ਅਤੇ ਤੁਹਾਡੇ ਪੇਜ ਤੋਂ ਸ਼ੋਪਿੰਗ ਕਰਨ ਲਈ ਜ਼ਰੂਰ ਬੋਲਾਂਗੀ ਅਤੇ ਮੈਂ ਤੁਸੀਂ ਜੋ ਮੈਨੂੰ ਡਿਸਕਾਊਂਟ ਦਿੱਤਾ ਹੈ ਟੈਨ ਪਰਸੈਂਟ ਦਾ ਮੈਂ ਉਸ ਨਾਲ ਬਹੁਤ ਖੁਸ਼ ਹਾਂ